ਹਾਂਜੀ ਬੇਨਤੀ ਹੈ ਜੀ ਮੋਬਾਇਲ ਡੁ ਡੁਪਲੀਕੇਟ ਮੋਬਾਇਲ ਰੀਚਾਰਜ ਦਾ ਜ਼ਿਕਰ ਹੈ ਜੀ ਕਿ ਜਿਹਦੇ ਵਿੱਚ ਅਸੀਂ ਗਰਾਂ ਗਾਹਕ ਦਾ ਦੋ ਵਾਰੀ ਰੀਚਾਰਜ ਹੋ ਗਿਆ ਡੁਪਲੀਕੇ ਜਿਸਨੂੰ ਅਸੀਂ ਡੁਪਲੀਕੇਟ ਰੀਚਾਰਜ ਕਹਿੰਦੇ ਹਾਂ ਅਤੇ ਇੱਕ ਰੀਚਾਰਜ ਵਾਪਸ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਜਾਂ ਰੀ ਵਾਪਸ ਉਸ 'ਤੇ ਪੈਸੇ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਡੁਪਲੀਕੇਟ ਰੀਚਾਰਜ ਲਈ ਬੇਨਤੀ ਹੈ ਪਲਸ ਉਸਨੂੰ ਈਮੇਲ 'ਤੇ ਜਾਂ ਮੋਬਾਈਲ ਨੰਬਰ 'ਤੇ ਉਹਨਾਂ ਦੀ ਵਾਪਸੀ ਕੀਤੀ ਜਾਵੇ ਲੈਣ ਦੇਣ ਦੀ ਵਾਪਸੀ ਕੀਤੀ ਜਾਵੇ ਮੋਬਾਇਲ ਫੋਨ ਵਿੱਚ ਦੋ ਰੀਚਾਰਜ ਹੋ ਚੁੱਕੇ ਨੇ ਇੱਕ ਤਾਂ ਐਕਟੀਵੇਟ ਹੋ ਗਿਆ ਦੂਸਰਾ ਵਾਪਸ ਲੈਣ ਦੀ ਰੀਚਾਰਜ ਦੀ ਅਮਾਊਂਟ ਰਕਮ ਨੂੰ ਵਾਪਸ ਲੈਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਦੌਰਾਨ ਇਹ ਮੋਬਾਈਲ ਨੈਟਵਰਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰੀਚਾਰਜ ਦਾ ਵੱਧ ਤੋਂ ਜਲਦ ਤੋਂ ਜਲਦ ਭੁਗਤਾਨ ਕਰਵਾਇਆ ਜਾਵੇ ਗਾਹਕ ਨੂੰ ਵੱਧ ਤੋਂ ਵੱਧ ਭੁਗਤਾਨ ਕਰਵਾਇਆ ਜਾਵੇ ਅਤੇ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਕੀਤੀ ਜਾਵੇ